ਲੰਬੇ ਸਫਰ ਲਈ ਬਾਈਕ ਦੀ ਸੰਭਾਲ ਸਾਨੂੰ ਕਈ ਤਰੀਕਿਆਂ ਨਾਲ ਕਰਨੀ ਚਾਹੀਦੀ ਹੈ ਜਿਵੇਂ ਕਿ ਸਾਨੂੰ ਲੰਬੇ ਸਫਰ ਜਾਣ ਤੋਂ ਪਹਿਲਾਂ ਬਾਈਕ ਦੀ ਸਰਵਿਸ ਕਰਵਾਉਣੀ ਚਾਹੀਦੀ ਹੈ ਅਤੇ ਉਸ ਦੇ ਬਾਰੇ ਕੁਝ ਜਾਣਕਾਰੀ ਲੈਣੀ ਚਾਹੀਦੀ ਹੈ ਕਿ ਜੇਕਰ ਸਾਡੀ ਬਾਈਕ ਰਸਤੇ ਵਿੱਚ ਖਰਾਬ ਹੋ ਜਾਵੇ ਤਾਂ ਅਸੀਂ ਉਸ ਨੂੰ ਕਿਵੇਂ ਠੀਕ ਕਰਨਾ ਹੈ ਅਤੇ ਸਾਨੂੰ ਬਾਈਕ ਲ ਲੰਬੇ ਸਫਰ 'ਚ ਲੈ ਕੇ ਜਾਣ ਤੋਂ ਪਹਿਲਾਂ ਨਾਲ ਸਾਨੂੰ ਫਸਟ ਏਡ ਕਿੱਟ ਹੋਰ ਉਸਦੇ ਕੁਝ ਸਪੇਅਰ ਪਾਰਟਸ ਅਤੇ ਚਾਬੀ ਆਦਿ ਕੁਝ ਨਾਲ ਰੱਖਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਇਹ ਸਿਕਿਉਰਿਟੀ ਰਹੇ ਕਿ ਸਾਡੀ ਬਾਈਕ ਜੇਕਰ ਰਸਤੇ 'ਚ ਖਰਾਬ ਹੋ ਜਾਵੇ ਤਾਂ ਸਾਨੂੰ ਡਰਨ ਦੀ ਕੋਈ ਗੱਲ ਨਹੀਂ ਹੈ ਅਸੀਂ ਇਸ ਨੂੰ ਠੀਕ ਕਰ ਸਕਦੇ ਹਾਂ ਅਤੇ ਇਸ ਮਦਦ ਦੇ ਨਾਲ ਅਸੀਂ ਇਸ ਨੂੰ ਅੱਗੇ ਲੰਘ ਕੇ ਆਪਣੀ ਬਾਈਕ ਨੂੰ ਚਲਾ ਸਕਦੇ ਹਾਂ